ਪੰਜਾਬ ਵਿੱਚ ਬਹੁਤ ਸਾਰੀਆਂ ਜਗ੍ਹਾ ਹਨ ਜਿਸ ਵਿੱਚ ਸ੍ਰੀ ਅੰਮ੍ਰਿਤਸਰ ਜਲ੍ਹਿਆਂ ਵਾਲਾ ਬਾਗ ਜਿੱਥੇ ਕਿ ਵਿਸਾਖੀ ਵਾਲੇ ਦਿਨ ਅੰਗਰੇਜ਼ਾ ਵੱਲੋਂ ਇਹ ਹਮਲਾ ਕੀਤਾ ਗਿਆ ਬਾਘਾ ਬਾਡਰ ਜਿੱਥੇ ਪੰਜਾਬ ਔਰ ਪਾਕਿਸਤਾਨ ਦੇ ਜਵਾਨ ਤੈਨਾਤ ਹਨ ਰੋਪੜ ਮਹਾਰਾਜਾ ਰਣਜੀਤ ਸਿੰਘ ਬਾਗ ਔਰ ਉਸ ਤੋਂ ਇਲਾਵਾ ਆਮ ਖਾਸ ਬਾਗ ਸਰਹਿੰਦ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿੱਥੇ ਕਿ ਲੋਕ ਨਤਮਸਤਕ ਹੋਣ ਜਾਂਦੇ ਹਨ ਚੱਪੜ ਚਿੱੜੀ ਖਰੜ ਜਿੱਥੇ ਕਿ ਇਹ ਇਸ ਤੋਂ ਇਲਾਵਾ ਕਪੂਰਥਲਾ ਸਾਇੰਸ ਸਿਟੀ ਹੈ ਚਮਕੌਰ ਸਾਹਿਬ ਸ਼ਹਾਦਤ ਏ ਦਾਸਤਾਨ ਦੀ ਜਗ੍ਹਾ ਬਣੀ ਹੋਈ ਹੈ